ਜੇਕਰ ਸਿਹਤ ਬੀਮੇ ਦੀ ਗੱਲ ਕੀਤੀ ਜਾਵੇ ਤਾਂ ਮੇਰਾ ਕੋਈ ਵੀ ਇਸ ਤਰ੍ਹਾਂ ਦਾ ਸਿਹਤ ਬੀਮਾ ਨਹੀਂ ਹੈ ਅਤੇ ਨਾ ਹੀ ਮੈਂ ਇਸ ਗੱਲ ਵਿੱਚ ਇੰਟਰਸਟ ਲਿਆ ਪਰ ਫਿਰ ਵੀ ਮੈਂ ਇੱਕ ਦਿਨ ਫੋਨ ਦੇਖ ਰਹੀ ਸੀ ਤਾਂ ਉਸ ਦੇ ਵਿੱਚ ਮੈਨੂੰ ਨਾ ਨੋਟੀਫਿਕੇਸ਼ਨ ਆਇਆ ਜਿਹਦੇ ਵਿੱਚ ਸਿਹਤ ਬੀਮੇ ਬਾਰੇ ਗੱਲ ਕੀਤੀ ਗਈ ਕਿ ਤੁਹਾਨੂੰ ਆਹ ਫੈਸਿਲਿਟੀਜ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਿੰਨਾਂ ਵਿੱਚੋਂ ਸਭ ਤੋਂ ਮੇਨ ਜਾਣਕਾਰੀ ਭਗਤ ਪੂਰਨ ਸਿੰਘ ਕਾਰਡ ਦੀ ਦਿੱਤੀ ਗਈ ਅਤੇ ਉਹਦੇ ਬਾਰੇ ਉਹਦੇ ਬਾਰੇ ਮੈਂ ਨੌਲੇਜ਼ ਲਈ ਫਿਰ ਤੋਂ ਮੈਂ ਇੱਕ ਵਾਰ ਸੋਚਿਆ ਕਿ ਕਿਉਂ ਨਾ ਇਹ ਇਹ ਜਿਹੜੀ ਲਾਈਨ ਆ ਵਧੀਆ ਵਾ ਮੈਂ ਇਹਨੂੰ ਇੱਕ ਵਾਰੀ ਮਤਲਬ ਜੁਆਇਨ ਕਰਕੇ ਦੇਖਾਂ ਤਾਂ ਮੈਂ ਇਸ ਬੀਮ ਸਿਹਤ ਬੀਮੇ 'ਚ ਇੰਟਰਸਟ ਲਿਆ ਤਾਂ ਮੇਰੇ ਹਸਬੈਂਡ ਰੋਜੇ ਡੇਲੀ ਉਹਨਾਂ ਦਾ ਮਤਲਬ ਵਰਕ ਜਿਹੜਾ ਉਹ ਪ੍ਰਾਈਵੇਟ ਜੋਬ ਕਰਦੇ ਨੇ ਉਹ ਅਪ ਡਾਊਨ ਕਰਦੇ ਰਹਿੰਦੇ ਨੇ ਤਾਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਨਾਲ ਨਾਲ ਉਹਨਾਂ ਦਾ ਸਿਹਤ ਬੀਮਾ ਵੀ ਕਰਵਾਵਾਂ ਇਸ ਲਈ ਹੁਣ ਮੈਂ ਤਾਂ ਮੈਂ ਆਪਣੇ ਹਸਬੈਂਡ ਦਾ ਦੋਨਾਂ ਦਾ ਸਿਹਤ ਬੀਮਾ ਕਰਵਾਇਆ ਜਿਹਦੇ ਵਿੱਚ ਕਿ ਅਲੱਗ ਅਲੱਗ ਤਰ੍ਹਾਂ ਦੀ ਫੈਸਿਲਿਟੀ ਸਰਕਾਰ ਵੱਲੋਂ ਮਿਲਦੀ ਰਹਿੰਦੀ ਹੈ ਅਤੇ ਜੋ ਕਿ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਟਾਈਮ 'ਤੇ ਸਭ ਨੂੰ ਇਹ ਇਹ ਫੈਸਿਲਿਟੀ ਦਾ ਫਾਇਦਾ ਜਿਹੜਾ ਉਠਾਉਣਾ ਚਾਹੀਦਾ ਅਤੇ ਜੇਕਰ ਸਾਡੀ ਲਾਈਫ 'ਚ ਕੋਈ ਵੀ ਅਚਾਨਕ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਹੋ ਜਾਂਦਾ ਤਾਂ ਸਿਹਤ ਬੀਮਾ ਸ ਜਿਹੜੀ ਇਹ ਸਾਨੂੰ ਪੈਸੇ ਜਾਂ ਨਹੀਂ ਪ੍ਰੋਵਾਈਡ ਕਰਦੇ ਨੇ ਆਪਣੇ ਇਲਾਜ ਵਾਸਤੇ ਜਾਂ ਕਿੱਦਾਂ ਵੀ ਹੈ ਤਾਂ ਸਾਨੂੰ ਜ਼ਰੂਰ ਇਸ ਯੋਜਨਾ ਦਾ ਫਾਇਦਾ ਲੈਣਾ ਚਾਹੀਦਾ